ਮੇਰਾ ਸਭ ਤੋਂ ਜ਼ਿਆਦਾ ਯਾਦਗਾਰ ਪਲ ਉਹ ਰਿਹਾ ਸੀ ਜਿਸ ਵੇਲੇ ਮੈਂ ਇੱਕ ਭਜਨ ਸੀ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਕਰਨਾ ਸੀ ਨਾਮ ਕੀਰਤਨ ਕਰਨਾ ਸੀ ਔਰ ਉਹ ਮੇਰੀ ਪਹਿਲੀ ਕੋਸ਼ਿਸ਼ ਸੀ ਜਿਹਦੇ ਵਿੱਚ ਬਹੁਤ ਸਾਰੇ ਕੀਰਤਨ 'ਚ ਲੋਕ ਆਏ ਹੁੰਦੇ ਹਨ ਅਤੇ ਉਹਨਾਂ ਦੇ ਸਾਹਮਣੇ ਗਾਉਣਾ ਸੀ ਅਤੇ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਾ ਕਿ ਮੈਂ ਗਾਇਆ ਹੈ ਔਰ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਲੋਕਾਂ ਦੇ ਅੰਦਰੋਂ ਜਿਹੜੀਆਂ ਰੱਬ ਦੇ ਨਾਮ ਦੀਆਂ ਭਾਵਨਾਵਾਂ ਸੀ ਉਹ ਆਂਸੂ ਅੱਥਰੂ ਉਹਨਾਂ ਦੀਆਂ ਅੱਖਾਂ ਚੋਂ ਨਿਕਲ ਰਹੇ ਸਨ ਅਤੇ ਪਤਾ ਲੱਗ ਰਿਹਾ ਸੀ ਕਿ ਹਾਂ ਉਹਨਾਂ ਦੇ ਦਿਲ ਨੂੰ ਜਿਹੜੇ ਮੇਰੇ ਉਹ ਸ਼ਬਦ ਨੇ ਉਹ ਬੋਲ ਨੇ ਉਹਨਾਂ ਦੇ ਦਿਲ ਤੱਕ ਛੂਏ ਨੇ ਔਰ ਕਿਉਂਕਿ ਉਹ ਐਸੀ ਭਾਵਨਾਵਾਂ ਸੀ ਕਿ ਮੇਰੇ ਖੁਦ ਦੇ ਹੱਥ ਜਿਹੜੇ ਸੀ ਗਾਉਣ ਤੋਂ ਬਾਅਦ ਜਦੋਂ ਮੈਨੂੰ ਉਸ ਚੀਜ਼ ਨੂੰ ਮੈਂ ਮਹਿਸੂਸ ਕੀਤਾ ਕਿ ਮੈਂ ਰੱਬ ਨੂੰ ਆਪਣੇ ਸਾਹਮਣੇ ਰੱਖ ਕੇ ਉਹ ਆਪਣਾ ਦੁੱਖ ਜਾਂ ਉਹ ਭਜਨ ਦੇ ਰੂਪ 'ਚ ਸੁਣਾ ਰਹੀ ਹਾਂ ਅਤੇ ਮੇਰੇ ਖੁਦ ਦੀਆਂ ਅੱਖਾਂ 'ਚ ਆਂਸੂ ਸੀ ਮੇਰੇ ਨਾਲ ਦੇ ਸਾਥੀ ਜਿਹੜੇ ਗਾ ਰਹੇ ਸਨ ਜਾਂ ਜਿਹੜਾ ਮੇਰਾ ਸਾਥ ਦੇ ਰਹੇ ਸਨ ਸੁਣਨ ਵਾਲੇ ਸਰੋਤਾ ਸਾਡੇ ਜਿਹੜੇ ਸਨ ਉਹ ਵੀ ਸਾਰਿਆਂ ਦੀਆਂ ਅੱਖਾਂ ਨਮ ਸੀ ਅਤੇ ਉੱਥੋਂ ਮੈਨੂੰ ਲੱਗਿਆ ਸੀ ਕਿ ਨਹੀਂ ਹਾਂ ਵਧੀਆ ਹੋ ਗਿਆ ਜੋ ਵੀ ਹੋਇਆ ਇਸ ਕਰਕੇ ਮਤਲਬ ਉਹ ਜਿਹੜਾ ਅਨੁਭਵ ਮੇਰਾ ਸੀ ਉਹ ਜ਼ਿੰਦਗੀ 'ਚ ਪਹਿਲੀ ਵਾਰ ਕਿਤੇ ਗਾਇਆ ਔਰ ਗਾ ਕੇ ਉਹ ਅਨੁਭਵ ਜਿਹੜਾ ਮੇਰੇ ਸਾਹਮਣੇ ਜੋ ਕੁਛ ਵੀ ਮੈਂ ਦੇਖਿਆ ਉਹ ਮੇਰੇ ਲਈ ਕਦੇ ਮੈਂ ਭੁੱਲ ਨਹੀਂ ਸਕਦੀ ਉਹਨੂੰ ਔਰ ਕੋਸ਼ਿਸ਼ ਕਰਾਂਗੀ ਕਿ ਅਗਲੀ ਵਾਰ ਤੋਂ ਵੀ ਜੇ ਕਦੇ ਮੈਨੂੰ ਕਦੇ ਗਾਉਣ ਦਾ ਮੌਕਾ ਮਿਲਦਾ ਭਜਨ ਅਤੇ ਮੈਂ ਭਜਨ ਕੀਰਤਨ ਨੂੰ ਇਸ ਤਰੀਕੇ ਨਾਲ ਕਰਾਂ ਕਿ ਲੋਕਾਂ ਦੇ ਦਿਲ ਤੱਕ ਛੂਹ ਜਾਵੇ ਆਵਾਜ਼ ਔਰ ਉਹਦੇ ਬੋਲ ਜਿਹੜੇ ਨੇ ਗਾਣੇ ਦੇ